ਭੰਗੜਾ ਸਾਡੇ ਪੰਜਾਬ ਦੀ ਸ਼ਾਨ ਹੈ ਕਿਸੇ ਵੀ ਦੇਸ਼ ਪ੍ਰਦੇਸ਼ ਵਿੱਚ ਚਲੇ ਜਾਓ ਉੱਥੇ ਭੰਗੜਾ ਵੇਖਣ ਨੂੰ ਮਿਲਦਾ ਹੈ ਭੰਗੜੇ ਦੀ ਆਪਣੀ ਵੱਖਰੀ ਹੀ ਪਹਿਚਾਣ ਹੈ ਭੰਗੜਾ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਹੈ ਕਿਸੇ ਖੁਸ਼ੀ ਦੇ ਮੌਕੇ 'ਤੇ ਅਲੱਗ ਅਲੱਗ ਗੀਤ ਗਾਏ ਜਾਂਦੇ ਹਨ ਰੰਗ ਬਿਰੰਗੇ ਕੱਪੜੇ ਸਾਡੇ ਮਨਾਂ ਨੂੰ ਮੋਹ ਲੈਂਦੇ ਹਨ ਕੱਪੜੇ ਪੰਜਾਬੀਆਂ ਦੇ ਭੰਗੜੇ ਵਿੱਚ ਸਾਡੇ ਪੁਰਾਣੇ ਕਲਚਰ ਨੂੰ ਦਰਸਾਉਂਦੇ ਹਨ ਉਹਨਾਂ ਦੇ ਗੀਤਾਂ ਵਿੱਚ ਮੁਟਿਆਰਾਂ ਦੀਆਂ ਖੂਬਸੂਰਤ ਤੀ ਦਰਸਾਉਣਾ ਗੱਭਰੂ ਦੀ ਮੁੱਛਾਂ ਅਤੇ ਉਹਨਾਂ ਦੀ ਜਵਾਨੀ ਮਾਣਨ ਦਾ ਸਾਰਾ ਜ਼ਿਕਰ ਦਰਸਾਇਆ ਜਾਂਦਾ ਹੈ ਭੰਗੜਾ ਢੋਲ ਤੋਂ ਬਿਨਾਂ ਬਿਲਕੁਲ ਨਹੀਂ ਸੱਜਦਾ ਢੋਲ ਦੀ ਤਾਲ 'ਤੇ ਹੀ ਢੋਲੀਆਂ ਦੇ ਪੈਰ ਆਪਣੇ ਆਪ ਨੱਚਣੇ ਨੂੰ ਤੁਰ ਪੈਂਦੇ ਹਨ ਜਿਸ ਨੂੰ ਭੰਗੜਾ ਨਾ ਵੀ ਆਵੇ ਉਹ ਵੀ ਭੰਗੜਾ ਪਾਉਣ ਲਈ ਮਜਬੂਰ ਹੋ ਜਾਂਦਾ ਹੈ ਸਾਡੇ ਪੰਜਾਬੀ ਵਿਰਸੇ ਵਿਰਸੇ ਨੂੰ ਦਰਸਾਉਂਦਾ ਹੈ ਸਾਡਾ ਪੰਜਾਬੀਆਂ ਦਾ ਨਹੀਂ ਇਹ ਦੇਸ਼ ਵਿਦੇਸ਼ ਵਿੱਚ ਵੀ ਭੰਗੜਾ ਪ੍ਰਚੱਲਿਤ ਹੈ ਸਾਡੇ ਭੰਗੜੇ ਨੂੰ ਮੁੱਖ ਰੱਖਦਿਆਂ ਹਰ ਪੰਜਾਬੀ ਲੋਕ ਅਤੇ ਸੰਗੀਤ ਇਸ ਤੋਂ ਆਨੰਦ ਮਾਣਨ ਲਈ ਵੱਧ ਤੋਂ ਵੱਧ ਲੋਕ ਹਿੱਸਾ ਲੈਂਦੇ ਹਨ